ਸਤਿ ਸ਼੍ਰੀ ਅਕਾਲ ਜੀ ਮੈਨੂੰ ਬਚਪਨ ਤੋਂ ਹੀ ਫੋਟੋਗ੍ਰਾਫਰੀ ਵਿੱਚ ਬਹੁਤ ਸ਼ੌਂਕ ਹੈ ਅਤੇ ਮੈਂ

ਮੇਰਾ ਜਿਸ ਲਈ ਮਨ ਕਰੇ ਮੈਂ ਉਸ ਲਈ ਫੋਟੋ ਖਿੱਚਣ ਚਲੇ ਜਾਂਦਾ ਕਦੀ ਆਪਣੇ ਯਾਰ ਦੀ ਯਾਰਾ ਦੋਸਤਾਂ ਨੂੰ ਲੈ ਕੇ ਚਲੇ ਜਾਂਦਾ ਕਦੀ ਇਕੱਲਾ ਚਲੇ ਜਾਂਦਾ ਅਤੇ ਫਿਰ ਉਹਨਾਂ ਨੂੰ ਆ ਕੇ ਬਾਅਦ ਚੋਂ ਐਡਿਟ ਐਡਿਟ ਕਰਨਾ ਫੋਟੋਆਂ ਨੂੰ ਫਿਰ ਉਹ ਫੋਟੋਆਂ ਆਪਣੇ ਯਾਰਾਂ ਦੋਸਤਾਂ ਨੂੰ ਸੈਂਡ ਕਰਨਾ ਉਹ ਅੱਗੇ ਆਪਣੇ ਫੋਨ ਵਿੱਚ ਰੱਖਦੇ ਹਾਂ ਯਾ ਯਾਦ ਟਾਈਪ ਰੱਖਦੇ ਆ ਅਤੇ ਇਸ ਫੋਟੋਗ੍ਰਾਫਰੀ ਨੂੰ ਬਹੁਤ ਹੀ ਅੱਗੇ ਜਾ ਕੇ ਸਕੋ ਇਹਦਾ ਸਕੋਪ ਹੈ ਕਿਉਂਕਿ ਅੱਜ ਕੱਲ੍ਹ ਬਹੁਤ ਕਮਾਈ ਹੈ ਫੋਟੋਗ੍ਰਾਫਰੀ ਵਿੱਚ ਮੇਰੀ ਇੱਕ ਆਪਣੀ ਮੈਂ ਚਾਹੁੰਦਾ ਕਿ ਮੇਰੀ ਇੱਕ ਆਪਣੀ ਦੁਕਾਨ ਹੋਵੇ ਅਤੇ ਮੈਂ ਉੱਥੇ ਫੋਟੋ ਆਪਣਾ ਇੱਕ ਕੈਮਰਾ ਰੱਖਾਂ ਵਧੀਆ ਤੋਂ ਵਧੀਆ ਅਤੇ ਫੋਟੋਆਂ ਖਿੱਚਵਾ ਲਓ ਮੇਰੇ ਤੋਂ ਸਾਰੇ ਆਉਣ ਫੋਟੋਆਂ ਖਿਚਾਉਣ ਐਡਿਟ ਕਰਵਾਉਣ ਅਤੇ ਮੈਨੂੰ ਇਸ ਇਹ ਕੰਮ ਕਰਕੇ ਬਹੁਤ ਹੀ ਖੁਸ਼ੀ ਮਿਲਦੀ ਆ ਅਤੇ ਅੱਜ ਕੱਲ੍ਹ ਵਿਆਹ ਦੇ ਵਿੱਚ ਵੀ ਲੋਕ ਬਹੁਤ ਹੀ ਸਾਰੀਆਂ ਫੋਟੋਆਂ ਖਿਚਵਾਂਦੇ ਹੈ ਕਿਉਂਕਿ ਇੱਕ ਉਹ ਆਪਣੀ ਯਾਦਗਿਰੀ ਰੱਖਦੇ ਹੈਗੇ ਜੀ ਸਾਡਾ ਇੱਕ ਟਾਈਮ ਚਲੋ ਵਿਆਹ ਹੋਇਆ ਸੀ ਅਤੇ

ਬੰਦਾ ਆਪਣੇ ਪੁਰਾਣੇ ਟਾਈਮ ਨੂੰ ਯਾਦ ਕਰਦਾ ਹੈ ਅਤੇ ਫੋਟੋਗ੍ਰਾਫਰੀ ਇੱਕ ਕੀ ਬਹੁਤ ਹੀ ਅੱਛੀ ਚੀਜ਼ ਆ ਯਾਦਾਂ ਵਾਸਤੇ ਅਤੇ ਅੱਜ ਕੱਲ੍ਹ ਤੁਹਾਨੂੰ ਪਤਾ ਤਰੱਕੀ ਤਰੱਕੀ ਨਾਲ ਫੋਟੋਆਂ ਆਈ ਏ ਆਈ ਦੇ ਨਾਲ ਕਿੰਨਾ ਕੁਛ ਫੋਟੋ ਨੂੰ ਚੇਂਜ ਕਰ ਸਕਦੇ ਹਾਂ ਅਤੇ ਇਸ ਕਰਕੇ ਮੈਨੂੰ ਬਹੁਤ ਹੀ ਇੰਟਰਸਟ ਹੈ ਫੋਟੋਗ੍ਰਾਫਰੀ ਵਿੱਚ